ਮੈਂ ਨੈੱਟਫਲਿਕਸ 'ਤੇ ਮੇਰਾ ਬਾਰਤ ਮਹਾਨ ਵੀਡੀਓ ਦੇਖੀ ਜਿਹੜੀ ਕਿ ਬਹੁਤ ਹੀ ਕਲੀਅਰ ਅਤੇ ਵਧੀਆ ਸੀ ਅਤੇ ਉਸਦੀ ਸਟ੍ਰੀਮਿੰਗ ਬਹੁਤ ਵਧੀਆ ਸੀ ਅਤੇ ਜਿਹੜੇ ਆਪਣੇ ਟੀ ਵੀ ਨਾਲੋਂ ਬਹੁਤ ਹੀ ਕਲੀਅਰ ਅਤੇ ਵਧੀਆ ਤਰੀਕੇ ਨਾਲ ਦਿਖ ਰਹੀ ਸੀ